ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਆਪਣੇ ਇੱਥੇ ਐਨ ਸੀ ਐਮ ਮੋਲ ਵੀ ਬਣਿਆ ਹੋਇਆ ਹੈ ਜੀ ਘੁੰਮਣ ਫਿਰਨ ਲਈ ਸ਼ੋਪਿੰਗ ਕਰਨ ਲਈ ਅਤੇ ਭੈਣਾਂ ਦਾ ਢਾਬਾ ਹੈ ਅਤੇ ਹਵੇਲੀ ਬਣੀ ਹੋਈ ਹੈ ਉੱਥੇ ਬਹੁਤ ਵਧੀਆ ਮਤਲਬ ਕੀ ਖਾਣਾ ਹੈ ਜਿੱਦਾਂ ਦਾ ਤੁਸੀਂ ਚਾਹੁੰਦੇ ਓ ਹਾਂਜੀ ਅਤੇ ਆਪਣੇ ਧਾਰਮਿਕ ਸਥਾਨ ਵੀ ਬਣੇ ਹੋਏ ਹੈ ਜੀ ਆਹ ਆਪਣਾ ਅੰਬ ਸਾਹਿਬ ਗੁਰਦੁਆਰਾ ਹੋ ਗਿਆ ਜਿਵੇਂ ਦਾਊ ਸਾਹਿਬ ਹੋ ਗਿਆ ਭੈਰੋ ਦਾ ਮੰਦਿਰ ਹੋ ਗਿਆ ਅਤੇ ਆਪਣਾ ਸਿੰਘ ਸ਼ਹੀਦਾ ਦਾ ਗੁਰਦੁਆਰਾ ਹੈ ਹਾਂਜੀ ਬਹੁਤ ਜਗ੍ਹਾਂ ਇੱਥੇ ਘੁੰਮਣੇ ਨੂੰ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਇੱਥੇ ਮਤਲਬ ਕੀ ਘੁੰਮਣ ਫਿਰਨ ਨੂੰ ਬਹੁਤ ਜਗ੍ਹਾਂ ਬਣੀਆ ਹੋਈਆ ਹੈ ਐਨ ਸੀ ਐਮ ਮੋਲ ਵਿੱਚ ਬਹੁਤ ਕੁਛ ਹੈ ਜੀ ਬੱਚਿਆਂ ਲਈ ਖੇਡਾਂ ਖੂਡਾ ਦਾ ਵੀ ਬਣਿਆ ਹੋਇਆ ਹੈ ਹਾਂਜੀ ਹਾਂਜੀ ਹਾਂਜੀ ਅਤੇ ਪਾਰਕ ਪੂਰਕ ਜੀ ਵਧੀਆ ਬਣੀਆ ਹੋਈਆਂ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਬਹੁਤ ਵਧੀਆ ਹੈ ਜੀ ਤੁਸੀਂ ਫਿਰ ਹਾਂਜੀ ਐਨ ਸੀ ਐਮ ਹਾਂਜੀ ਐਨ ਸੀ ਐਮ ਮਾਲ ਦੇ ਵਿੱਚ ਬਹੁਤ ਅਲੱਗ ਅਲੱਗ ਵਰਾਇਟੀਆਂ ਦੇ ਉਹ ਬਣਾਏ ਹੋਏ ਹੈ ਜੀ ਤੁਸੀਂ ਜਿਹੜਾ ਹਾਂਜੀ ਅਲੱਗ ਅਲੱਗ ਤਰ੍ਹਾਂ ਦੇ ਆ ਵਧੀਆ ਹੈ ਇੱਥੇ ਸ਼ੋਪਿੰਗ ਲਈ ਵੀ ਹੋਰ ਮਤਲਬ ਕੀ ਹੋਰ ਵੀ ਦੁਕਾਨਾਂ ਹੈਗੀਆਂ ਹੈ ਵਧੀਆਂ ਤੁਸੀਂ ਜੇ ਜਿੱਦਾਂ ਦਾ ਤੁਸੀਂ ਚਾਹੋ ਓਦਾ ਦਾ ਤੁਹਾਨੂੰ ਮਤਲਬ ਕੀ ਮਿਲਜੂਗੀ ਸ਼ੋਪਿੰਗ ਜਿੱਦਾਂ ਦੀ ਤੁਸੀਂ ਕਰਨੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਕੋਈ ਨਾ ਜੀ ਜਦੋ ਮਰਜ਼ੀ ਆਜਿਓ ਤੁਸੀਂ ਅਸੀਂ ਤੁਹਾਨੂੰ ਘੁੰਮਾ ਦੁ ਘੁੰਮਾ ਵੀ ਦਵਾਗੇ ਹਾਂਜੀ ਹਾਂਜੀ ਠੀਕ ਹੈ ਜੀ ਓਕੇ